ਸ਼ਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਮੈਨੂੰ ਉਮੀਦ ਹੈ ਕੀ ਤੁਸੀਂ ਠੀਕ ਹੋਵੋਗੇ ਮੈਂ ਤੁਹਾਡੇ ਤੋਂ ਬਿਨਾਂ ਜਾਨਨਾ ਹੈ ਕੀ ਤੁਹਾਡੇ ਮੁਹੱਲੇ ਵਿੱਚ ਵੀ ਬਿਜਲੀ ਕੱਟ ਬਹੁਤ ਵੱਧ ਗਏ ਹਨ ਸਾਡੇ ਮੁਹੱਲੇ ਵਿੱਚ ਬਿਜਲੀ ਦਾ ਬਹੁਤ ਕੱਟ ਹੁੰਦਾ ਹੈ ਅਸੀਂ ਇਸ ਤੋਂ ਬਹੁਤ ਪਰੇਸਾਨ ਹਾਂ ਮੈਂ ਤੁਹਾਡੇ ਤੋਂ ਇਹੀ ਪੁੱਛਨਾ ਹੈ ਕੀ ਤੁਹਾਡੇ ਮੁਹੱਲੇ ਵਿੱਚ ਇਹ ਪਰੇਸ਼ਾਨੀਆਂ ਕਦੋਂ ਤੋਂ ਆ ਰਹੀਆਂ ਹਨ ਆਪਾਂ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ ਮੈਂ ਤੁਹਾਡੇ ਨਾਲ ਇਹੀ ਕਾਰ ਹੀ ਗੱਲ ਕਰਨੀ ਹੈ ਅੱਜ ਆਪਾਂ ਸਭ ਨੂੰ ਇਕੱਠੇ ਹੋ ਕੇ ਇੱਕ ਅਰਜੀ ਲਿਖ ਕੇ ਬੀਜਲੀ ਵਿਭਾਗ ਵਿੱਚ ਦੇਨੀ ਚਾਹੀਦੀ ਹੈ ਤੁਹਾਨੂੰ ਵੀ ਪਤਾ ਹੈ ਕੀ ਅੱਜ ਦੇ ਸਮੇਂ ਵਿੱਚ ਸਾਰਾ ਕੁਝ ਬਿਜਲੀ ਤੇ ਹੀ ਚੱਲਦਾ ਹੈ ਬਿਜਲੀ ਦਾ ਪਰਯੋਗ ਹਰ ਕੰਮ ਲਈ ਕੀਤਾ ਜਾਂਦਾ ਹੈ ਤੁਸੀਂ ਜਦੋਂ ਵੀ ਆਪਣਾ ਕੋਈ ਕੰਮ ਕਰਦੇ ਹੋ ਤਾਂ ਉਸ ਵਿੱਚ ਬਿਜਲੀ ਦਾ ਉਪਯੋਗ ਹੀ ਹੁੰਦਾ ਹੈ ਕਿਰਪਾ ਕਰਕੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਮੁਹੱਲੇ ਦੇ ਸਾਰੇ ਮੈਂਬਰ ਸਰਪੰਚ ਅਤੇ ਸਾਡੇ ਨਾਲ ਆਪਾਂ ਸਾਰੇ ਮਿਲ ਕੇ ਕਮੇਟੀ ਦਫ਼ਤਰ ਨਾਲ ਗੱਲ ਕਰੀਏ ਅਤੇ ਮੁਹੱਲੇ ਵਿੱਚ ਆ ਕੇ ਅਸੀਂ ਸਾਰੇ ਮੀਟਿੰਗ ਕਰਦੇ ਹਾਂ ਤਾਂ ਜੋ ਇਸ ਸਮੱਸਿਆ ਦਾ ਹੱਲ ਕੱਢ ਸਕੀਏ ਇਸ ਕਰਕੇ ਅੱਜ ਕੱਲ ਬਿਜਲੀ ਦੇ ਬਿੱਲ ਬਹੁਤ ਹੀ ਜਿਆਦਾ ਵੀ ਵੱਧ ਗਏ ਹਨ ਮੈਂ ਅੱਜ ਸ਼ਾਮ ਨੂੰ ਤੁਹਾਡਾ ਇੰਤਜ਼ਾਰ ਕਰਾਂਗਾ ਆਪਾਂ ਸਭ ਨੇ ਮਿਲ ਕੇ ਬਿਜਲੀ ਦੇ ਵਿਭਾਗ ਨੂੰ ਅਰਜੀ ਦੇਨੀ ਹੈ ਕੀ ਸਾਨੂੰ ਇਸ ਸਮੱਸਿਆ ਦਾ ਹੱਲ ਨਿਕਾਲ ਕੇ ਦਿਓ ਅਤੇ ਸਾਨੂੰ ਜੋ ਵੀ ਅਸੀਂ ਉਪਯੋਗ ਮੋਬਾਈਲ ਟੀਵੀ ਦੀ ਅਪਯੋਗ ਕਰਦੇ ਆਂ ਤਾਂ ਉਹ ਸਭ ਬਿਜਲੀ ਤੇ ਹੀ ਹੁੰਦਾ ਹੈ ਇਸ ਕਰਕੇ ਕਿਰਪਾ ਕਰਦੇ ਹਾਂ ਕੀ ਸਾਰੇ ਹੀ ਮੌਹੱਲੇ ਦੇ ਮੈਂਬਰ ਨਿਵਾਸੀ ਆ ਕੇ ਬਿਜਲੀ ਮਹਿਕਮੇ ਵਿੱਚ ਅਰਜੀ ਦੇ ਸਕੀਏ ਜੋ ਸਾਡੀ ਇਸ ਸਮੱਸਿਆ ਦਾ ਹੱਲ ਹੋ ਸਕੇ